ਪੰਜਾਬ ਦੇ ਵਿੱਚ ਕਲਾ ਕਈ ਤਰ੍ਹਾਂ ਦੇ ਸ਼ਿਲਪਕਾਰੀਆਂ ਵੱਲੋਂ ਕੀ ਵਜੋਂ ਕੀਤੀ ਜਾਂਦੀ ਹੈ ਪੰਜਾਬ ਵਿੱਚ ਕਈ ਤਰ੍ਹਾਂ ਦੇ ਕਲਾ ਕ੍ਰਿਤੀਆਂ ਦੇ ਕੰਮ ਵੀ ਕੀਤੇ ਜਾਂਦੇ ਹਨ ਬਹੁਤ ਸਾਰੀਆਂ ਕਲਾ ਹਨ ਜੋ ਕਿ ਸਿਰਫ ਪੰਜਾਬ ਵਿੱਚ ਹੀ ਹੁੰਦੀਆਂ ਹਨ ਜਿਵੇਂ ਫੁਲਕਾਰੀ ਬੁਣਨਾ ਪੰਜਾਬੀ ਜੁੱਤੀਆਂ ਦਾ ਕੰਮ ਮਿੱਟੀ ਦੇ ਭਾਂਡੇ ਬਣਾਉਣਾ ਆਦਿ ਪੰਜਾਬ ਵਿੱਚ ਇਨ੍ਹਾਂ ਕਲਾ ਕ੍ਰਿਤੀਆਂ ਨੂੰ ਦੁਨੀਆਂ ਭਰ ਨੇ ਹੀ ਸਰਾਹਿਆ ਹੈ ਪੰਜਾਬ ਦੇ ਵਿੱਚ ਲੱਕੜ ਦਾ ਕੰਮ ਵੀ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਦੇ ਵਿੱਚ ਲੱਕੜ ਦੇ ਖਿਡੌਣੇ ਵੀ ਬਹੁਤ ਆਉਂਦੇ ਹਨ ਜਿਨ੍ਹਾਂ ਨੂੰ ਕਿ ਰਾਜ ਪੱਧਰ 'ਤੇ ਹੀ ਜਾਣਿਆ ਜਾਂਦਾ ਹੈ ਸ਼ਿਲਪਕਾਰੀ ਕੁਦਰਤੀ ਵਾਤਾਵਰਨ ਅਨੁਸਾਰ ਹੀ ਆਪਣੇ ਕਿੱਤੇ ਜਿਹੜੇ ਆ ਉਹ ਬਦਲਦੇ ਹੀ ਰਹਿੰਦੇ ਹਨ ਇਹਨਾਂ ਸਾਰੀਆਂ ਕਲਾ ਕ੍ਰਿਤੀਆਂ ਨੂੰ ਹਰ ਕੋਈ ਸਮਾਣ ਕਰਦਾ ਹੈ